ਪੰਜਾਬ ਵਿੱਚ ਕਈ ਲੋਕ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਦੇ ਹਨ ਪਹਿਲੇ ਟਾਈਮਾਂ ਵਿੱਚ ਪੰਜਾਬ ਦੇ ਲੋਕ ਅੰਧ ਵਿਸ਼ਵਾਸ ਬਹੁਤ ਜ਼ਿਆਦਾ ਕਰਦੇ ਸੀ ਜਿਵੇਂ ਕਿ ਜਦੋਂ ਕੋਈ ਬਿੱਲੀ ਰਾਹ ਕੱਟ ਜਾਂਦੀ ਸੀ ਤਾਂ ਉਸ ਨੂੰ ਉਸ ਰਾਹ ਨੂੰ ਟੱਪਿਆ ਨਹੀਂ ਸੀ ਜਾਂਦਾ ਸਗੋਂ ਘਰ ਵਾਪਿਸ ਆ ਜਾਂਦੇ ਸੀ ਇਸ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਅਤੇ ਪੰਜਾਬ ਵਿੱਚ ਜਦੋਂ ਕੋਈ ਰਾਤ ਨੂੰ ਕੁੱਤੇ ਭੌਂਕਦੇ ਤਾਂ ਉਸਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਉਦੋਂ ਕਿਹਾ ਜਾਂਦਾ ਕਿ ਜਿੱਦਾਂ ਕੋਈ ਜਮਦੂਤ ਹੈ ਤਾਂ ਉਹ ਕਿਸੇ ਨੂੰ ਲੈਣ ਆਇਆ ਤਾਂ ਇਸ ਲਈ ਬਾਹਰ ਨਹੀਂ ਜਾਂਦੇ ਡਰਦੇ ਮਾਰੇ ਅਤੇ ਪੰਜਾਬ ਵਿੱਚ ਪੰਜਾਬ ਵਿੱਚ ਕਈ ਤਰਾਂ ਦੇ ਚੌਰਾਹੇ ਹਨ ਜਿਨ੍ਹਾਂ 'ਤੇ ਜਿਨ੍ਹਾਂ ਵਿੱਚ ਕਈ ਲੋਕ ਕਈ ਤਰ੍ਹਾਂ ਦੀ ਸਮੱਗਰੀ ਜਿਵੇਂ ਕਿ ਲਾਲ ਕੱਪੜਾ ਸਿੰਧੂਰ ਦਾਰੂ ਦੀ ਬੋਤਲ ਅਤੇ ਨਾਰੀਅਲ ਆਦਿਵਾਦੀ ਕਈ ਹੋਰ ਤਰਾਂ ਦੀ ਵਸਤੂਆਂ ਨੂੰ ਰੱਖ ਕੇ ਠੀਕ ਹੈ ਉੱਥੇ ਟੂਣਾ ਮਾਣਾ ਕਰਦੇ ਹਨ ਜਿਨ੍ਹਾਂ ਨੂੰ ਟੱਪਣਾ ਵੀ ਲੋਕ ਚੰਗਾ ਨਹੀਂ ਸਮਝਦੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਉਸ ਟੂਣੇ ਨੂੰ ਕੋਈ ਟੱਪਦਾ ਹੈ ਤਾਂ ਉਹ ਉਹ ਬੰਦਾ ਬੰਦੇ ਨੂੰ ਕੋਈ ਜ਼ਰਾ ਭੂਤ ਕਹਿ ਲਉ ਜਾਂ ਕਹਿ ਲਉ ਕਿ ਉਹ ਜਾਨਵਰ ਬਣ ਜਾਂਦਾ ਹੈ ਠੀਕ ਹੈ ਪੰਜਾਬ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਹਨ ਜਿਵੇਂ ਕਿ ਜਦੋਂ ਕੋਈ ਜਾਂਦਾ ਹੋਇਆ ਛਿੱਕ ਵੀ ਮਾਰ ਦਿੰਦਾ ਹੈ ਤਾਂ ਉਸ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ